ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓ ਹਾਂਜੀ ਹਾਂਜੀ ਵਧੀਆ ਹੈਲੋ ਹਾਂਜੀ ਹਾਂਜੀ ਮਿਲ ਜੂਗੀ ਮਿਲ ਜੂਗੀ ਜੀ ਹਾਂ ਹਾਂ ਹਾਂ ਹਾਂ ਰਹਿਤ ਲਾ ਕੇ ਤੁਹਾਨੂੰ ਦੇਦਾਂਗੇ ਕੋਈ ਗੱਲ ਨਹੀਂ ਦੱਸੋ ਕੀ ਕੁਛ ਲੈਣਾ ਤੁਸੀਂ

ਇੱਕ ਪੀਸ ਪੈ ਜੂਗਾ ਪੰਜ ਰੁਪਏ ਦਾ ਪੂਰੀ ਪੰਜਾਹ ਰੁਪਏ ਦੀ ਪੈ ਜੂਗੀ ਜੀ ਠੀਕ ਹੈ ਨਹੀਂ ਜੀ ਇਹ ਰੇਜ਼ਰ ਦਾ ਹਾਂਜੀ

ਪੈਨਸਲ ਦੀ ਹੈਲੋ ਪੈਨਸਲ ਵੀ ਪੰਜਾਹ ਰੁਪਏ ਦੀ ਪੈ ਜੂਗੀ ਯਾਨੀ ਕਿ ਪੰਜ ਰੁਪਏ ਹਾਂਜੀ ਹਾਂਜੀ ਨਾਲ ਉਹਦੇ ਸ਼ੋਪਨਰ ਅਤੇ ਜੀ ਹੋਰ ਦੱਸੋ ਜੀ ਸਕੇਲ ਪੈ ਜੂਗਾ ਸਰ ਪੰਜਾਹ ਰੁਪਏ ਸਟੀਲ ਵਾਲਾ ਲੈਣਾ ਤਾਂ ਪੰਜਾਹ ਦਾ ਰੁਪਏ ਪਊਗਾ ਫਿਰ ਤੀਹ ਰੁਪਏ ਦਾ ਪਊਗਾ ਜੀ ਤੀਹ ਰੁਪਏ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਮਿਲ ਜੂ ਉਹ ਸ ਉਹ ਸਰ ਚਾਲੀ ਕੁ ਰੁਪਏ ਦੀ ਰੇਂਜ 'ਚ ਪਿਆ ਆਪਣੇ ਕੋਲ ਇੱਕ ਪੰਜਾਹ ਰੁਪਏ ਉਸ ਤੋਂ ਵਧੀਆ ਉਹ ਪਰ

ਸ਼ੋਪਨਰ ਵੀ ਮਿਲ ਜਾਣਗੇ ਸਰ ਪੰਜ ਰੁਪਏ ਦਾ ਇੱਕ ਪੀਸ ਹੈ ਅਤੇ ਨਟਰਾਜ ਦਾ ਨਟਰਾਜ ਦਾ ਆਪਣੇ ਕੋਲ ਵਧੀਆ ਕੁਆਲਿਟੀ ਦਾ ਸ਼ੋਪਨਰ ਹੈ ਕਾਪੀਆਂ ਦੇਖੋ ਸਰ ਇਹ ਦੇਖੋ ਦੇਖ ਆ ਕਾਪੀ ਦਾ ਰੇਟ ਰੇਟ ਇਹ ਆ ਕਿ ਇਹ ਆਪਣੇ ਸ਼ੁ ਸ਼ੁਰੂ ਹੋ ਜਾਂਦੀ ਆ ਅ ਦਸ ਰੁਪਏ ਤੋਂ ਦਸ ਰੁਪਏ ਵਾਲੀ 'ਚ ਪੇਜ਼ ਥੋੜ੍ਹੇ ਹੁੰਦੇ ਆ ਜਿੰਨੀ ਆਪਾਂ ਜ਼ਿਆਦਾ ਵਾਲੀ ਮਹਿੰਗੀ ਲਵਾਂਗੇ ਉਹਦੇ 'ਚ ਪੇਜ ਜ਼ਿਆਦਾ ਹੁੰਦੇ ਆ ਬਾਅਦ 'ਚ ਆ ਜਾਂਦੇ ਆ ਰਜਿਸਟਰ ਰਜਿਸਟਰ ਕਹਿਣ ਦਾ ਮਤਲਬ ਤੋਂ ਸ਼ੁਰੂ ਹੋ ਜਾਂਦੇ ਆ ਜ ਜ ਹੈਲੋ ਅੱਠ ਨੰਬਰ ਫਿਰ ਇਹ ਅੱਠ ਨੰਬਰ 'ਤੇ ਇੱਕ ਜ਼ਿਆਦਾ ਪੇਜ 'ਤੇ ਇੱਕ ਪੰਜ ਸੌ ਪੇਜ 'ਤੇ ਇੱਕ ਵਗ ਜਾਂਦਾ ਜੀ ਠੀਕ ਹੈ ਇੱਕ ਨੰਬਰ ਤੋਂ ਹਾਂਜੀ ਜੀ ਜੇ ਲੈ ਜਾਓ ਵੈਸੇ ਬੱਚੇ ਵਾਸਤੇ ਤਾਂ ਹਾਂਜੀ ਤੁਹਾਨੂੰ ਵੀਹ ਕੁ ਰੁਪਏ ਦਾ ਵੀਹ ਕੁ ਰੁਪਏ ਦਾ ਲਗਾ ਦੇਵਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਸਰ ਦੇਖੋ ਮਹਿੰਗੀ ਦੇਖੋ ਜ ਜ ਵੈਸੇ ਨਟਰਾਜ ਦੀ ਇੱਕ ਸਿੰਪਲ ਰੇਜ਼ਰ ਆਉਂਦੀ ਹੈ ਉਹ ਵੀ ਵੈਸੇ ਤਾਂ ਵਧੀਆ ਹੁੰਦੀ ਹੈ ਪਰ ਇੱਕ ਜਿਵੇਂ ਟੋਆਏ ਦੇ ਵਿੱਚ ਆਉਂਦੀ ਆ ਹੈ ਨਾ ਬੱਚੇ ਯਾਨੀ ਕਿ ਖਿਲੌਣਿਆਂ ਦੇ ਵਿੱਚ ਉਹ ਦਸ ਰੁਪਏ ਵੀਹ ਰੁਪਏ ਇੱਦਾਂ ਦੀ ਰੇਂਜ 'ਚ ਬ ਆ ਜਾਂਦੀ ਹੈ ਹਾਂਜੀ ਹਾਂਜੀ ਹਾਂ ਹਾਂ ਤੇ ਇੱਥੇ ਦੁਕਾਨ 'ਤੇ ਆ ਜਾਓ ਦੁਕਾਨ 'ਤੇ ਆ ਜਾਓ ਕੋਈ ਦਿੱਕਤ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ